ਭਾਰਤ ਦੇ ਫੈਸ਼ਨ ਦੀ ਗੱਲ ਕਰਾਂ ਤਾਂ ਇਹ ਸ਼ੁਰੂ ਤੋਂ ਹੀ ਅਲੱਗ ਅਲੱਗ ਥਾਂਵਾਂ ਦੇ ਲਈ ਅਲੱਗ ਅਲੱਗ ਕੱਪੜੇ ਲੋਕਾਂ ਵੱਲੋਂ ਪਾਏ ਜਾਂਦੇ ਨੇ ਅਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸ਼ੁਰੂਆਤ ਤੋਂ ਹੀ ਕੁੜਤਾ ਪਜਾਮਾ ਅਤੇ ਚਾਦਰਾ ਲੋਕਾਂ ਦੀ ਪਸੰਦ ਰਿਹਾ ਹੈ ਲੇਕਿਨ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਆ ਜਿਹੜਾ ਜੀਨਾਂ ਦਾ ਅਤੇ ਸ਼ਰਟਾਂ ਦਾ ਇਹਨਾਂ ਦਾ ਕਨਸੈਪਟ ਹੈ ਇਹ ਭਾਰਤ ਦੇ ਫੈਸ਼ਨ ਦੇ ਨਾਲ ਵਿੱਚ ਮਿਲ ਗਿਆ ਹੈ ਅਤੇ ਅੱਜ ਕੱਲ੍ਹ ਲੋਕ ਇਨ੍ਹਾਂ ਨੂੰ ਹੀ ਪ ਪਾਉਣਾ ਪਸੰਦ ਕਰਦੇ ਨੇ ਨ ਅੰਗਰੇਜ਼ਾਂ ਦੇ ਜਿਹੜੇ ਕੱਪੜੇ ਨੇ ਅੰਗਰੇਜ਼ਾਂ ਦੇ ਜਿਹੜੀਆਂ ਕੰਪਨੀਆਂ ਨੇ ਕੱਪੜਿਆਂ ਦੀਆਂ ਜਿਵੇਂ ਕਿ ਪੁਮਾਂ ਐਡੀਡਾਸ ਨਾਈਕੀ ਇਹ ਸਾਰੀ ਕੰਪਨੀਆਂ ਹਨ ਵਿਸ਼ਵ ਪ੍ਰਸਿੱਧ ਕੰਪਨੀਆਂ ਨੇ ਜਿਹੜੀ ਕਿ ਭਾਰਤ ਦੇ ਲੋਕਾਂ ਨੂੰ ਵੀ ਪਸੰਦ ਆਉਂਦੀਆਂ ਨੇ ਖਾਸਕਰ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਨੂੰ ਕੱਪੜਿਆਂ ਦੇ ਨਾਲ ਬੜਾ ਲਗਾਵ ਹੈ ਭਾਰਤ ਦੇ ਵਿੱਚ ਸ਼ੁਰੂਆਤ ਤੋਂ ਹੀ ਕਿਉਂਕਿ ਲੋਕ ਬਹੁਤ ਮਿਹਨਤੀ ਸਨ ਤਾਂ ਜਿਹੜੇ ਕੱਪੜੇ ਨੇ ਖੇਤੀਬਾੜੀ ਵਾਲੇ ਕੱਪੜੇ ਨੇ ਧੋਤੀ ਹੋ ਗਈ ਅਤੇ ਹੈ ਨਾ ਉ ਉੱਪਰ ਕਮੀਜ਼ ਕਮੁਜ਼ ਨਾ ਹੋਣਾ ਇਹ ਸਾਰੀ ਉਹਨਾਂ ਦੇ ਫੈਸ਼ਨ ਦੇ ਵਿੱਚ ਸੀਗਾ ਪਰ ਹੁਣ ਦੀ ਜੇ ਅਸੀਂ ਅ ਅਜੋਕੇ ਸਮੇਂ ਦੀ ਜੇ ਅਸੀਂ ਗੱਲ ਕਰੀਏ ਤਾਂ ਜਿਹੜਾ ਫੈਸ਼ਨ ਹੈ ਉਹ ਬੜਾ ਹੀ ਸਮੇਂ ਦੇ ਨਾਲ ਬਦਲਦਾ ਰਹਿੰਦਾ ਹੈ ਨ ਦੋ ਕੁ ਮਹੀਨੇ ਪੈਂਟਾਂ ਸਟਰੇਟ ਹੋ ਜਾਂਦੀਆ ਨੇ ਦੋ ਕੁ ਮਹੀਨੇ ਬਾਅਦ ਪੈਂਟਾਂ ਖੁੱਲ੍ਹੀਆਂ ਹੋ ਜਾਂਦੀਆਂ ਨੇ ਸਮੇਂ ਦੇ ਹਿਸਾਬ ਦੇ ਨਾਲ ਟਰੈਂਡਾਂ ਦੇ ਹਿਸਾਬ ਦੇ ਨਾਲ ਫਿਲਮਾਂ ਗਾਣਿਆਂ ਇਹਨਾਂ ਦੇ ਹਿਸਾਬ ਦੇ ਨਾਲ ਕੱਪੜੇ ਅਤੇ ਉਹਨਾਂ ਦਾ ਫੈਸ਼ਨ ਬਦਲਦਾ ਰਹਿੰਦਾ ਹੈ